ਅਨੰਦਪੁਰ ਸਾਹਿਬ ਬਹੁਤ ਹੀ ਵਧੀਆ ਜਗ੍ਹਾ ਹੈ ਅਤੇ ਇਸਦੇ ਆਸ ਪਾਸ ਵੀ ਬਹੁਤ ਹੀ ਵਧੀਆ ਗੁਰਦੁਆਰੇ ਅਤੇ ਮੰਦਰ ਹਨ ਲੋਕ ਅਨੰਦਪੁਰ ਸਾਹਿਬ ਦਰਸ਼ਨ ਕਰਕੇ ਚਲੇ ਜਾਂਦੇ ਹਨ ਪਰ ਇਸਦੇ ਲਾਗੇ ਲਾਗੇ ਹੋਰ ਹੀ ਬਹੁਤ ਇਤਿਹਾਸਿਕ ਗੁਰਦੁਆਰੇ ਹਨ ਜਿਵੇਂ ਕਿ ਗੁਰੂ ਕਾ ਲਾਹੌਰ ਨੰਗਲ ਬਿਬੋਰ ਸਾਹਿਬ ਨੈਣਾ ਦੇਵੀ ਮੰਦਰ ਚਿੰਤਪੁਰਨੀ ਮੰਦਰ ਆਦਿ ਲੋਕ ਇਨ੍ਹਾਂ ਜਗ੍ਹਾਵਾਂ ਦੇ ਦਰਸ਼ਨ ਨਹੀਂ ਕਰਦੇ ਸਿਰਫ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਚਲੇ ਜਾਂਦੇ ਹਨ ਇਹਨਾਂ ਜਗ੍ਹਾਵਾਂ ਦੇ ਵੀ ਸਾਨੂੰ ਦਰਸ਼ਨ ਕਰਨੇ ਚਾਹੀਦੇ ਹਨ ਕਿਉਂਕਿ ਇਹ ਵੀ ਸਾਡੇ ਇਤਿਹਾਸ ਵਿੱਚ ਬਹੁਤ ਮਾਇਨੇ ਰੱਖਦੇ ਹਨ ਅਤੇ ਲੋਕ ਇਹਨਾਂ ਦੇ ਦਰਸ਼ਨ ਕੀਤੇ ਬਗੈਰ ਹੀ ਵਾਪਸ ਚਲੇ ਜਾਂਦੇ ਹਨ ਅਤੇ ਉਹਨਾਂ ਦਾ ਇੰਨੀ ਦੂਰ ਆਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਵੀ ਜਾਉ ਤਾਂ ਲਾਗੇ ਲਾਗੇ ਜਿੰਨੇ ਵੀ ਗੁਰਦੁਆਰੇ ਹਨ ਸਾਰਿਆਂ ਦੇ ਦਰਸ਼ਨ ਕਰਕੇ ਆਉ ਜਿਵੇਂ ਗੁਰੂ ਕਾ ਲਾਹੌਰ ਬਿਬੋਰ ਸਾਹਿਬ ਆਦਿ ਗੁਰਦੁਆਰਿਆਂ ਦੇ ਦਰਸ਼ਨ ਕਰੋ ਅਤੇ ਕੀਰਤਪੁਰ ਸਾਹਿਬ ਦੇ ਵੀ ਦਰਸ਼ਨ ਕਰੋ ਵਾਪਸ ਆਉਂਦੇ ਸਮੇਂ ਨੈਣਾ ਦੇਵੀ ਮੰਦਰ ਦੇ ਵੀ ਦਰਸ਼ਨ ਕਰਕੇ ਆਉ ਉਹ ਵੀ ਬਹੁਤ ਵਧੀਆ ਮੰਦਰ ਬਣਿਆ ਹੋਇਆ ਹੈ